ਦੌੜਦੇ ਸਮੇਂ ਸਾਨੂੰ ਲੰਬੇ ਲੰਬੇ ਸਾਹ ਲੈਣੇ ਚਾਹੀਦੇ ਹਨ ਅਤੇ ਸਾਨੂੰ ਸਭ ਤੋਂ ਪਹਿਲਾਂ ਹੌਲੀ ਹੌਲੀ ਦੌੜਨਾ ਚਾਹੀਦਾ ਹੈ ਫਿਰ ਇਸ ਤੋਂ ਬਾਅਦ ਅਸੀਂ ਰਫਤਾਰ ਬੜਾ ਸਕਦੇ ਹਾਂ ਇਸ ਤਰੀਕੇ ਨਾਲ ਆਪਣੀ ਮਾਨਸਿਕਤਾ 'ਤੇ ਚੰਗਾ ਪ੍ਰਭਾਵ ਪੈਂਦਾ ਹੈ ਅਤੇ ਸਰੀਰ ਵੀ ਵਧੀਆ ਰਹਿੰਦਾ ਹੈ ਅਤੇ ਦੌੜਨ ਤੋਂ ਬਾਅਦ ਸਰੀਰ ਬਹੁਤ ਹੀ ਚੰਗਾ ਮਹਿਸੂਸ ਕਰਦਾ ਹੈ ਇਸ ਦੇ ਨਾਲ ਸਰੀਰ ਵਿੱਚ ਇੱਕ ਅਲੱਗ ਹੀ ਚੀਜ਼ ਮਹਿਸੂਸ ਹੁੰਦੀ ਹੈ